ਪੰਜਾਬ ਵਿੱਚ ਸਿੱਖਿਆ ਵਿੱਚ ਸੁਧਾਰ ਕਰਨ ਲਈ ਸਰਕਾਰੀ ਪਹਿਲਕਦਮੀਆਂ ਬਹੁਤ ਅਤੇ ਬਹੁਤ ਨੀਤੀਆਂ ਬਣਾਉਣੀਆਂ ਚਾਹੀਦੀਆਂ ਨੇ ਜਿਵੇਂ ਫੰਡਿੰਗ ਵਿੱਚ ਆਪਾਂ ਗੱਲ ਕਰ ਸਕਦੇ ਹਾਂ ਸਕੂਲਾਂ ਵਿੱਚ ਜਿਵੇਂ ਸ ਸਾਇੰਸ ਲੈਬ ਮੈਥ ਲੈਬ ਬਣਾਉਣੀਆਂ ਚਾਹੀਦੀਆਂ ਨੇ ਅਤੇ ਬਣ ਹੈ ਵੀ ਨੇ ਕਈ ਸਕੂਲਾਂ ਵਿੱਚ ਜਿਸ ਨਾਲ ਬੱਚੇ ਪ੍ਰੈਕਟੀਕਲੀ ਸਿੱਖਣ 'ਤੇ ਜ਼ੋਰ ਦੇ ਸਕਦੇ ਹਨ ਤਾਂ ਜੋ ਥਿਊਰੈਟੀਕਲੀ ਕਿਤਾਬੀ ਕੀੜਾ ਨਾ ਬਣ ਸਕਣ ਪ੍ਰੈਕਟੀਕਲੀ ਸਿੱਖ ਕੇ ਬੱਚੇ ਜਲਦੀ ਵੀ ਸਿੱਖ ਜਾਂਦੇ ਹਨ ਅਤੇ ਅਧਿਆਪਕ ਸਿਖਲਾਈ ਨਾਲ ਜਿਵੇਂ ਸੈਮੀਨਾਰ ਹੋਣੇ ਚਾਹੀਦੇ ਨੇ ਤਾਂ ਜੋ ਨਵੀਂ ਟੈਕਨਾਲੋਜੀ ਔਰ ਨਿਊ ਇੰਪਰੂਵਮੈਂਟ ਆ ਸਕੇ ਟੀਚਰਸ ਵਿੱਚ ਨਵੀਂ ਟੈਕਨਾਲੋਜੀ ਨਾਲ ਉਹ ਔਰ ਐਡਵਾਂਸਮੈਂਟ ਨਾਲ ਉਹ ਯੂਜ ਟੂ ਹੋ ਸਕਣ ਤਾਂ ਜੋ ਉਹਨਾਂ ਦਾ ਵੀ ਇੱਕ ਪੱਧਰ ਉੱਚਾ ਹੋ ਸਕੇ ਜਿਸ ਨਾਲ ਅਗਰ ਅਧਿਆਪਕ ਵਧੀਆ ਲੈਵਲ 'ਤੇ ਬੱਚਿਆਂ ਨੂੰ ਪੜ੍ਹਾ ਸਕਦਾ ਹੈ ਅਧਿਆਪਕ ਚੰਗੀ ਟੈਕਨਾਲੋਜੀ ਔਰ ਐਜੂਕੇਸ਼ਨ ਕੁਆਲੀਫਿਕੇਸ਼ਨ ਨਾਲ ਹੋਵੇ ਅਤੇ ਉਹ ਬੱਚਿਆਂ ਨੂੰ ਵੀ ਬਹੁਤ ਵਧੀਆ ਪੜ੍ਹਾ ਸਕਦਾ ਹੈ ਅਤੇ ਪਾਠਕ੍ਰਮ ਸੁਧਾਰ ਲਈ ਜਿਵੇਂ ਐਜੂਕੇਸ਼ਨਲ ਫੰਡਾਮੈਂਟਲ ਰਾਈਟ ਹੈ ਸ ਛੇ ਤੋਂ ਚੌਦ੍ਹਾਂ ਸਾਲ ਤੱਕ ਬੱਚਿਆਂ ਦੀ ਫਰੀ ਐਂਡ ਕੰਪਲਸਰੀ ਐਜੂਕੇਸ਼ਨ ਹੋ ਸਕੇ ਕੋਸਟੀਟਿਊਸ਼ਨਲ ਰਾਈਟ ਆ ਛੇ ਤੋਂ ਚੌਦ੍ਹਾਂ ਸਾਲ ਤੱਕ ਦੇ ਬੱਚਿਆਂ ਨੂੰ ਲਾਜ਼ਮੀ ਪੜ੍ਹਨਾ ਜਰੂਰੀ ਹੈ ਤਾਂ ਕਿ ਉਹਨਾਂ ਦਾ ਐਜੂਕੇਸ਼ਨਲ ਲੈਵਲ ਉੱਚਾ ਉੱਠ ਸਕੇ ਅਤੇ ਘਰ ਦੀ ਸਥਿਤੀ ਵੀ ਸੁਧਾਰ ਆ ਸਕੇ ਉਹ ਚੰਗਾ ਰੁਜ਼ਗਾਰ ਲੱਭ ਸਕਣ ਅਤੇ ਪਾਠਕ੍ਰਮ ਸੁਧਾਰ ਵਜ਼ੀਫੇ ਹੋਣੇ ਚਾਹੀਦੇ ਨੇ ਜਿਵੇਂ ਸਕੋਲਰਸ਼ਿਪ ਬੱਚਿਆਂ ਨੂੰ ਮਿਲੇ ਅਤੇ ਬੱਚੇ ਅੱਗੇ ਆ ਕੇ ਅੱਛੇ ਅੰਕ ਪ੍ਰਾਪਤ ਕਰਕੇ ਫਰੀ ਜੋ ਸਕੋਲਰਸ਼ਿਪ ਨੇ ਉਹ ਲੈ ਸਕਣ ਜੋ ਆਪਣੇ ਘਰੋਂ ਬਹੁਤ ਤੰਗ ਨੇ ਪਿੱਛੇ ਨੇ ਪੈਸੇ ਪੱਖੋਂ ਅਤੇ ਆਪਣਾ ਘਰ ਦਾ ਸੁਧਾਰ ਕਰ ਸਕਣ ਓਵਰਆਲ ਐਜੂਕੇਸ਼ਨਲ ਕੁਆਲੀਫਿਕੇਸ਼ਨ ਲੈ ਕੇ ਆਪਣੇ ਜ਼ਿੰਦਗੀ ਸਵਾਰ ਸਕਣ